ਸਤਿ ਸ਼੍ਰੀ ਅਕਾਲ ਜੀ ਤੁਸੀਂ ਧਾਲੀਵਾਲ ਕੈਬ ਏਜੰਸੀ ਦੇ ਡਰਾਈਵਰ ਗੱਲ ਕਰ ਰਹੇ ਹੋਂ ਮੈਂ ਤੁਹਾਡੀ ਕੈਬ ਖਰੜ ਤੋਂ ਰੋਪੜ ਸਰਕਾਰੀ ਦਫਤਰ ਜਾਣ ਲਈ ਬੁੱਕ ਕੀਤੀ ਸੀ ਕੈਬ ਮੈਂ ਇਸ ਲਈ ਬੁੱਕ ਕੀਤੀ ਸੀ ਕਿਉਂਕਿ ਮੈਂ ਜਲਦੀ ਉੱਥੇ ਪਹੁੰਚਣਾ ਸੀ ਪਰ ਮੈਨੂੰ ਕੈਬ ਬੁੱਕ ਕੀਤੀ ਨੂੰ ਵੀਹ ਬਾਈ ਮਿੰਟ ਹੋ ਚੁੱਕੇ ਨੇ ਤੁਸੀਂ ਹਾਲੇ ਤੱਕ ਨਹੀਂ ਆਏ ਤੁਸੀਂ ਮੈਨੂੰ ਸੱਤ ਅੱਠ ਮਿੰਟ ਦਾ ਟਾਈਮ ਦਿੱਤਾ ਸੀ ਹੁਣ ਤਾਂ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੈ ਤੁਸੀਂ ਇੰਨਾਂ ਟਾਈਮ ਕਿੱਥੇ ਲਗਾ ਰਹੇ ਹੋ ਮੈਨੂੰ ਸੱਚ ਦੱਸ ਦੇਵੋ ਕਿਉਂਕਿ ਮੈਂ ਅੱਗੇ ਆਪਣੇ ਕੰਮ ਉੱਤੇ ਜਾਣ ਲਈ ਕਾਫੀ ਲੇਟ ਹੋ ਰਹੀ ਹਾਂ